ਮੇਰੇ ਖੇਤਰ ਵਿੱਚ ਟਰਾਂਸਪੋਰਟ ਬੱਸਾਂ ਟੈਕਸੀਆਂ ਆਟੋ ਰਿਕਸ਼ਾ ਟਰੇਨ ਪ੍ਰਾਈਵੇਟ ਬੱਸਾਂ ਅਤੇ ਹਵਾਈ ਸੁਵਿਧਾ ਵੀ ਉਪਲਬਧ ਹੈ ਜੋ ਕਿ ਸਾਡੇ ਟਰੈਵਲ ਨੂੰ ਬਹੁਤ ਹੀ ਸੌਖਾ ਕਰ ਦਿੰਦੀਆਂ ਹਨ ਅਤੇ ਅਸੀਂ ਘੱਟ ਸਮੇਂ ਵਿੱਚ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਟਰੈਵਲ ਕਰ ਸਕਦੇ ਹਾਂ ਖਾਸ ਕਰਕੇ ਹਵਾਈ ਜਹਾਜ਼ਾਂ ਰਾਹੀਂ ਸਾਡੇ ਸ਼ਹਿਰ ਸਾਡੇ ਖੇਤਰ ਵਿੱਚ ਜ਼ਿਆਦਾਤਰ ਟਰਾਂਸਪੋਰਟ ਬੱਸਾਂ ਉੱਤੇ ਡਿਪੈਂਡ ਹੈ ਕਿਉਂਕਿ ਲੋਕਾਂ ਨੇ ਲੋਕਲ ਸਿਟੀ ਟੂ ਸਿਟੀ ਟਰੈਵਲ ਕਰਨਾ ਹੁੰਦਾ ਹੈ ਅਤੇ ਉਹ ਬੱਸਾਂ ਰਾਹੀਂ ਕਰਦੇ ਹਨ ਜੇ ਕਿਸੇ ਨੇ ਕੰਟਰੀ ਦੇ ਅੰਡਰ ਟਰੈਵਲ ਕਰਨਾ ਹੁੰਦਾ ਹੈ ਤਾਂ ਉਹ ਜ਼ਿਆਦਾਤਰ ਹਵਾਈ ਜਹਾਜ਼ਾਂ ਦਾ ਜਾਂ ਫਿਰ ਟਰੇਨਾਂ ਦਾ ਇਸਤੇਮਾਲ ਕਰਦੇ ਹਨ ਕਿਉਂਕਿ ਇਹ ਬਹੁਤ ਹੀ ਜਲਦੀ ਸਫ਼ਰ ਪੂਰਾ ਕਰ ਦਿੰਦੀਆਂ ਹਨ ਜੇ ਕਿਸੇ ਨੇ ਕੰਟਰੀ ਤੋਂ ਬਾਹਰ ਜਾਣਾ ਹੁੰਦਾ ਹੈ ਤਾਂ ਉਹ ਹਵਾਈ ਜਹਾਜ਼ਾਂ ਦਾ ਯੂਜ਼ ਕਰਦਾ ਹੈ ਕਿਉਂਕਿ ਹਵਾਈ ਜਹਾਜ਼ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਬਹੁਤ ਹੀ ਘੱਟ ਸਮੇਂ ਵਿੱਚ ਪਹੁੰਚਾ ਦਿੰਦੇ ਹਨ ਅਤੇ ਇਹ ਬਹੁਤ ਹੀ ਕਨਵੀਨੀਅਟ ਹਨ ਪਰ ਕਈ ਲੋਕ ਜ਼ਿਆਦਾਤਰ ਟ੍ਰੇਨਾਂ ਨੂੰ ਪ੍ਰੈਫਰ ਕਰਦੇ ਹਨ ਕਿਉਂਕਿ ਹਵਾਈ ਜਹਾਜ਼ਾਂ ਦੀ ਟਿਕਟ ਲੋਕਲ ਸਫ਼ਰ ਲਈ ਬਹੁਤ ਹੀ ਕੋਸਟਲੀ ਹੁੰਦੀ ਹੈ